ਹਾਂਜੀ ਮੈਡਮ ਹਾਂਜੀ ਮੈਡਮ ਹਾਂਜੀ ਮੈਡਮ ਹਾਂਜੀ ਹਾਂਜੀ ਠੀਕ ਹੈ ਮੈਮ ਜੀ ਹਾਂਜੀ ਮੈਂ ਸੁਭਾ ਆ ਜੂੰਗੀ ਟਾਈਮ ਨਾਲ ਹਾਂਜੀ ਹਾਂਜੀ ਮੈਮ ਮੈਂ ਸੁਭਾ ਜਲਦੀ ਆ ਜੂੰਗੀ ਝਾੜੂ ਪੋਚਾ ਕਰਕੇ ਤੁਹਾਡੇ ਨਾਲ ਭਾਂਡੇ ਭੁੰਡੇ ਵੀ ਸਾਫ ਕਰਾ ਦੂੰਗੀ ਅਤੇ ਜਿਹੜਾ ਖਾਣਾ ਖੁਣਾ ਉਹ ਵੀ ਬਣਵਾ ਦੂੰਗੀ ਠੀਕ ਹੈ ਤੁਸੀਂ ਮਸਾਲੇ ਬਣਾ ਕੇ ਰੱਖਿਆ ਜੋ ਅਤੇ ਖਾਣਾ ਖੁਣਾ ਬਣਵਾ ਦੂੰਗੀ ਅਤੇ ਤੁਹਾਡੇ ਮਤਲਬ ਗੈਸਟਾਂ ਨੂੰ ਬਣਾਉਣ ਵਿੱਚ ਵੀ ਮਤਲਬ ਸਰਵ ਮਦਦ ਵੀ ਹਾਂਜੀ ਹਾਂਜੀ ਹਾਂਜੀ ਸਰਵ ਕਰਨ 'ਚ ਮਦਦ ਕਰ ਦੂੰਗੀ ਹਾਂਜੀ ਠੀਕ ਹੈ ਮੈਮ ਜੀ ਹੋਰ ਠੀਕ ਠਾਕ ਹੋ ਤੁਸੀਂ ਕਦੋਂ ਆਉਣਗੇ ਗੈਸਟ ਤੁਹਾਡੇ ਘਰ ਮੈਮ ਕਿੰਨੇ ਵਜੇ ਆਉਣਾ ਸੁਭਾ ਠੀਕ ਹੈ ਮੈਮ ਨੌ ਵਜੇ ਆਜਾਂ ਠੀਕ ਹੈ ਮੈਮ ਤੁਹਾਡੇ ਘਰ ਅੱਠ ਵਜੇ ਆ ਜਾਂ ਮੈਮ ਜੀ ਠੀਕ ਹੈ ਮੈਮ ਜੀ ਹਾਂਜੀ ਮੈਂ ਟਾਈਮ ਨਾਲ ਆ ਜਾਂਗੀ ਠੀਕ ਹੈ ਜੀ ਹਾਂਜੀ ਬਸ ਮੈਂ ਜਿਵੇਂ ਸਫਾਈ ਵਗੈਰਾ ਕਰਕੇ ਫਿਰ ਮੈਂ ਤੁਹਾਡੇ ਨਾਲ ਬਰਤਨ ਸਾਫ ਕਰਾ ਦਾਂਗੀ ਖਾਣਾ ਖੁਣਾ ਬਣਾ ਲਾਂਗੇ ਠੀਕ ਹੈ ਹਾਂਜੀ ਕੋਈ ਹੋਰ ਵੀ ਕੋਈ ਕੰਮ ਹੋਇਆ ਅਤੇ ਕੋਈ ਗੱਲ ਨਹੀਂ ਉਹ ਵੀ ਕਰ ਦਾਂਗੇ ਠੀਕ ਹੈ ਜੀ ਹਾਂਜੀ ਮੈਂ ਟਾਈਮ ਨਾਲ ਆ ਜਾਂਗੀ ਹੋਰ ਸੁਣਾਓ ਘਰ ਤਬੀਅਤ ਠੀਕ ਹੈ ਹਾਂਜੀ ਹੋਰ ਮੈਮ ਜੀ ਨਹੀਂ ਨਹੀਂ ਮੈਡਮ ਮੈਂ ਬਸ ਆਪਦੇ ਬੱਚਿਆਂ ਨੂੰ ਤਾਂ ਛੁੱਟੀ ਹੈ ਬਸ ਮੈਂ ਸੁਭਾ ਟਾਈਮ ਨਾਲ ਹੀ ਆ ਜਾਂਗੀ ਹਾਂਜੀ ਕੋਈ ਨਹੀਂ ਆ ਕੇ ਬਸ ਮੈਂ ਤੁਸੀਂ ਤੁਸੀਂ ਟੈਂਸ਼ਨ ਨਾ ਲਓ ਬਸ ਮੈਂ ਆ ਕੇ ਤੁਹਾਡਾ ਵੀ ਮਤਲਬ ਤੁਹਾਡੇ ਨਾਲ ਹੈਲਪ ਹੁਲਪ ਕਰਾ ਦਾਂਗੀ ਕੰਮ ਕੁੰਮ ਕਰਕੇ ਪੋਚੇ ਪੁਚੇ ਲਾ ਕੇ ਹਾਂਜੀ ਤੁਹਾਡੇ ਨਾਲ ਹੈਲਪ ਕਰਾ ਦਾਂਗੀ ਠੀਕ ਹੈ ਮੈਮ ਹਾਂਜੀ ਹਾਂਜੀ